ਮੈਂ ਬਹੁਤ ਸਾਰੇ ਪੰਛੀ ਦੇਖਣ ਬਹੁਤ ਵਾਰ ਪੰਛੀ ਦੇਖਣ ਲੱਗੀ ਅਤੇ ਮੈਨੂੰ ਬਹੁਤ ਯਾਦ ਹੈ ਕਿ ਇੱਕ ਵਾਰ ਮੈਂ ਪੰਛੀ ਦੇਖਣ ਗਈ ਸੀ ਤਾਂ ਇੱਕ ਸਧਾਰਨ ਪੰਛੀ ਨੂੰ ਦੇਖਿਆ ਸੀ ਜਿਸ ਵਿੱਚ ਬਲੂ ਨਿਊ ਦੇ ਬਰਡ ਕਿਹਾ ਜਾਂਦਾ ਹੈ ਇਹ ਪੰਛੀ ਛੋਟਾ ਜਿਹਾ ਪੰਛੀ ਹੈ ਉਹ ਜੋ ਆਮ ਤੌਰ 'ਤੇ ਏਸ਼ੀਆ ਦੇ ਜੰਗਲਾਂ ਵਿੱਚ ਮਿਲਦਾ ਹੈ ਅਤੇ ਇਸਨੂੰ ਇਹ ਰੰਗ ਬਰੰਗਾ ਹੁੰਦਾ ਹੈ ਅਤੇ ਮੈਂ ਇਸ ਰੰਗ ਬਰੰਗਾ ਹੁੰਦਾ ਹੈ ਤਾਂ ਸਭ ਤੋਂ ਵੱਖਰਾ ਵੱਖਰਾ ਵੱਖਰਾ ਦਿਸਦਾ ਇਸ ਦੀ ਸੰਖਿਆ ਘੱਟ ਹੈ ਇਸ ਇਹ ਕਦੇ ਕਦੇ ਹੀ ਦਿਖਦਾ ਹੈ ਜਦੋਂ ਮੈਂ ਪੰਛੀ ਦੇਖਿਆ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਸੀ ਮੈਂ ਆਪਣੇ ਆਪ ਨੂੰ ਕਿਸਮਤ ਵਾਲੀ ਮੰਨਿਆ ਜ ਕਿਉਂਕਿ ਇਹ ਪੰਛੀ ਕਿਸੇ ਨੂੰ ਨਹੀਂ ਦੇਖਣ ਨੂੰ ਮਿਲਦਾ ਹੈ ਮੈਂ ਮੇਰੇ ਨਾਲ ਦੀ ਮੇਰਾ ਪਰਿਵਾਰ ਗਿਆ ਸੀ ਅਤੇ ਮੈਂ ਪੰਛੀ ਨੂੰ ਪੰਛੀ ਇਹ ਮੇਰੇ ਸਾਰੇ ਪਰਿਵਾਰ ਨੇ ਦੇਖਿਆ ਸੀ ਮੇਰੇ ਸਾਰੇ ਪਰਿਵਾਰ ਨੂੰ ਇਹ ਪੰਛੀ ਦੇਖ ਕੇ ਖੁਸ਼ੀ ਹੋਈ ਅਤੇ ਅਸੀਂ ਸਭ ਇਹ ਪੰਛੀ ਦੇਖਣ ਬਾਰੇ ਸੋਚਿਆ ਅਤੇ ਪਰ ਸਾਨੂੰ ਦਿਖਿਆ ਨਾ ਦੁਨੀਆਂ ਵਿੱਚ ਸਭ ਬਹੁਤ ਸਾਰੇ ਪੰਛੀ ਹੁੰਦੇ ਹਨ ਕਈ ਤਰ੍ਹਾਂ ਦੇ ਪੰਛੀ ਹੁੰਦੇ ਹਨ ਜਿਵੇਂ ਕਿ ਕਬੂਤਰ ਤੋਤਾ ਕੁੱਕੜ ਬੁਲਬੁਲ ਹੁੰਦੇ ਹਨ ਅਤੇ ਪੰਛੀ ਸੌਖੇ ਤਰੀਕੇ ਨਾਲ ਦੇਖਣ ਨੂੰ ਜਾਂਦੇ ਹਨ ਅਤੇ ਮੇਰਾ ਮਨ ਪਸੰਦ ਪੰਛੀ ਬਲੀਡ ਬਰਡ ਹੈ ਕੁੱਕੜ ਵੀ ਬਹੁਤ ਸੁੰਦਰ ਹੁੰਦਾ ਹੈ ਪਰ ਉਸਦੇ ਰੰਗੀਨ ਪੰਖ 'ਤੇ ਹੁੰਦੇ ਹਨ ਅਤੇ ਉਸਦਾ ਨਾਚ ਵੀ ਸੋਹਣਾ ਹੁੰਦਾ ਹੈ ਇਸਦੇ ਨੱਚਣ ਨਾਲ ਬਹੁਤ ਹੁੰਦਾ ਹੈ